ਪੰਜਾਬ ਵਿੱਚ ਜਿਵੇਂ ਕਿ ਮੈਂ ਖੇਤੀਬਾੜੀ ਕਿੱਤੇ ਨਾਲ ਥੋੜ੍ਹਾ ਜਿਹਾ ਰੱਖਦਾ ਹਾਂ ਕਰਤਾਰ ਇੱਕ ਕੰਬਾਈਨ ਮੈਨ ਕੰਬਾਈਨ ਮੈਨੂਫੈਕਚਰ ਹੈ ਜੋ ਕਿ ਰੋਟਾਵੇਟਰ ਕੰਬਾਈਨਾਂ ਜਾਂ ਹੋਰ ਵੀ ਬੜੇ ਸਾਰੇ ਖੇਤੀਬਾੜੀ ਦੇ ਸੰਦ ਆਪ ਬਣਾਉਂਦੇ ਹਨ ਅਤੇ ਉਹਨਾਂ ਦੇ ਬਣਾਏ ਹੋਏ ਸੰਦ ਭਾਰਤ ਦੇ ਵਿੱਚ ਕਈ ਥਾਵਾਂ 'ਤੇ ਜਾਂਦੇ ਵੀ ਹਨ ਕਈ ਵਿਦੇਸ਼ਾਂ ਦੇ ਵਿੱਚ ਵੀ ਜਾਂਦੇ ਹਨ ਅਤੇ ਉਹਨਾਂ ਦੀ ਇਹ ਜੋ ਉਹਨਾਂ ਦਾ ਸਟਾਰਟਅਪ ਸੀਗਾ ਬੜੇ ਸਮੇਂ ਪਹਿਲਾਂ ਉਹਨਾਂ ਨੇ ਸ਼ੁਰੂ ਕੀਤਾ ਸੀ ਇਹ ਅਤੇ ਅੱਜ ਇਹ ਮਾਰਕੀਟ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਚਲਾ ਗਿਆ ਹੈ ਅਤੇ ਹੋਰ ਜੇ ਮੈਂ ਗੱਲ ਕਰਾਂ ਤਾਂ ਇੱਕ ਵੀਰ ਜੀ ਮਲਾਈ ਚਾਂਪ ਵਾਲੇ ਨੇ ਇੱਥੇ ਲੁਧਿਆਣਾ ਦੇ ਵਿੱਚ ਜਿੱਥੇ ਉਹਨਾਂ ਦਾ ਇਹ ਸਟਾਰਟਅਪ ਹੁਣ ਫਰੈਂਚਾਈਜੀਆਂ ਦੇ ਵਿੱਚ ਬਦਲ ਗਿਆ ਪਿੱਛੇ ਜਿਹੇ ਮੈਨੂੰ ਇੱਕ ਸਨੈਕਰ ਨਾਮ ਦਾ ਸਟਾਰਟਅਪ ਸੀ ਜਿਹੜਾ ਤਿੰਨ ਭਰਾਵਾਂ ਨੇ ਸ਼ੁਰੂ ਕੀਤਾ ਸੀਗਾ ਵਧੀਆ ਮਾਰਕੀਟਿੰਗ ਅਤੇ ਗਲੋਬਲ ਫੰਡਸ ਦੇ ਕਰਕੇ ਉਹ ਵੀ ਅੱਜ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਪਹੁੰਚ ਚੁੱਕਿਆ ਜਿਵੇਂ ਕਿ ਅੱਜ ਕੱਲ੍ਹ ਹਰ ਇੱਕ ਨੂੰ ਫਾਸਟ ਫੂਡ ਖਾਣ ਦਾ ਜਾਂ ਬਾਹਰਲਾ ਖਾਣ ਦੀ ਆਦਤ ਪਈ ਹੋਈ ਹੈ ਤਾਂ ਉਹ ਚੀਜ਼ ਨੂੰ ਉਹਨਾਂ ਨੇ ਲੋਕਾਂ ਦੀ ਲੋੜ ਹੀ ਬਣਾ ਦਿੱਤੀ ਅਤੇ ਆਪਣਾ ਬਿਜਨਸ ਵੀ ਬਣਾ ਦਿੱਤਾ